ਸਤਿ ਸ਼੍ਰੀ ਅਕਾਲ ਕਿਵੇਂ ਕੀ ਵਧੀਆ ਜੀ ਤੁਸੀਂ ਦੱਸੋ ਮੈਂ ਇੱਧਰ ਰੋਪੜ ਨਵਾਂਸ਼ਹਿਰ ਹਿੱਲ ਸਟੇਸ਼ਨ 'ਤੇ ਨਵੀਂ ਆਈ ਹਾਂ ਅਤੇ ਮੈਨੂੰ ਥੋੜ੍ਹਾ ਸਬਜ਼ੀ ਕਿੱਦਾਂ ਹਾਂਜੀ ਹਾਂਜੀ ਅਤੇ ਤੁ ਤੁਸੀਂ ਤਾਂ ਪਹਿਲਾਂ ਤੋਂ ਇੱਥੇ ਬਹੁਤ ਟਾਈਮ ਤੋਂ ਰਹਿੰਦੇ ਹੈ ਨਾ ਹਾਂਜੀ ਫਿਰ ਤੁਹਾਨੂੰ ਤਾਂ ਸਭ ਇੱਥੇ ਦਾ ਪਤਾ ਹੋਣਾ ਹੈ ਮੈਂ ਘਰ ਅੱਜ ਘਰ ਗੈਸਟ ਆਉਣੇ ਹੈ ਤਾਂ ਸਬਜ਼ੀ ਬਣਾਉਣੀ ਸੀ ਮੈਨੂੰ ਸਬਜ਼ੀ ਮੰਡੀ ਦਾ ਕੁਛ ਪਤਾ ਨਹੀਂ ਲੱਗ ਰਿਹਾ ਕਿ ਸਬਜ਼ੀ ਕਿੱਥੋਂ ਮਿਲਦੀ ਹੈ ਕੁਛ ਹੈਲਪ ਕਰ ਸਕਦੇ ਹੋ ਤੁਸੀਂ ਮੇਰੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਤੁਸੀਂ ਤੁਸੀਂ ਨਾਲ ਨਾਲ ਚਲੂੰਗੇ ਮੈਨੂੰ ਥੋੜ੍ਹੀ ਕੰਨਫਿਊਜ਼ਨ ਹੁੰਦੀ ਹੈ ਇੱਥੇ ਦੇ ਰਸਤਿਆਂ ਦੀ ਥੋੜ੍ਹੀ ਹੈਲਪ ਕਰ ਦੂੰਗੇ ਕੋਈ ਨਾਲ ਕਿਸੇ ਨੂੰ ਭੇਜ ਦੂੰਗੇ ਹਾਂਜੀ ਹਾਂਜੀ ਹਾਂਜੀ ਕਿੰਨੇ ਕੁ ਵਜੇ ਤੱਕ ਆ ਜੂੰਗੇ ਜਾਉਂਗੇ ਠੀਕ ਹੈ ਫਿਰ ਆਪਾਂ ਘੰਟੇ ਕੁ ਤੱਕ ਚੱਲਦੇ ਹਾਂ ਠੀਕ ਹੈ ਹਾਂਜੀ ਹਾਂਜੀ ਹਾਂਜੀ ਹੋਰ ਆਹੀ ਦਸ ਕੁ ਦਿਨ ਹੋਏ ਹੈ ਹਾਂਜੀ ਹਾਂਜੀ ਮੈਂ ਇੱਥੇ ਜੌਬ ਕਰਦੀ ਹਾਂ ਟੀਚਿੰਗ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਜ਼ਰੂਰ ਹਾਂਜੀ ਠੀਕ ਹਾਂ ਜੀ ਓਕੇ ਥੈਂਕ ਯੂ ਹਾਂਜੀ ਹਾਂਜੀ ਠੀਕ ਹੈ

ਹਾਂਜੀ ਹਾਂਜੀ ਕੋਈ ਨਹੀਂ ਓਕੇ ਜ਼ਰੂਰ ਜ਼ਰੂਰ ਠੀਕ